ਲਿਖਣ ਲਈ ਕੋਈ ਚੁਣੌਤੀ ਮੈਂ ਹਾਲੇ ਤੱਕ ਮਹਿਸੂਸ ਨਹੀਂ ਕੀਤੀ ਛੋਟੇ ਛੋਟੇ ਲੇਖ ਲਿਖੇ ਨੇ ਕਵਿਤਾ ਲਿਖੀ ਹੈ ਜਾਂ ਆਪਣੇ ਵਿਦਿਆਰਥੀਆਂ ਲਈ ਭਾਸ਼ਣ ਲਿਖੇ ਨੇ ਜਾਂ ਬਾਲ ਸਾਹਿਤ ਲਿਖਿਆ ਹੈ ਬੱਚਿਆਂ ਲਈ ਹੀ ਮੈਂ ਬਹੁਤਾ ਲਿਖਿਆ ਕਿਉਂਕਿ ਅਧਿਆਪਕ ਹਾਂ ਸਕੂਲ ਦੇ ਵਿੱਚ ਵਿਚਰਦੀ ਹਾਂ ਥੋੜ੍ਹੀ ਬਹੁਤੀ ਕਵਿਤਾ ਦਾ ਮੈਂ ਸ਼ੌਕ ਰੱਖਦੀ ਹਾਂ ਕੋਈ ਬਹੁਤ ਵੱਡੇ ਲੇਖਕਾਂ 'ਚ ਮੈਂ ਸ਼ੁਮਾਰ ਨਹੀਂ ਹਾਂ ਹਾਂ ਉਹਨਾਂ ਨੂੰ ਪੜ੍ਹਦੀ ਹਾਂ ਸੁਣਦੀ ਹਾਂ ਸਮਝਦੀ ਹਾਂ ਪਰ ਕੁਝ ਚੁਣੌਤੀ ਅੱਜ ਤੱਕ ਮੈਨੂੰ ਮਹਿਸੂਸ ਨਹੀਂ ਹੋਈ ਨਿੱਕੇ ਨਿੱਕੇ ਨਾਟਕ ਵੀ ਬੱਚਿਆਂ ਲਈ ਲਿਖੇ ਲਿਖ ਕੇ ਬੱਚਿਆਂ ਨੂੰ ਫੜਾ ਦਿੱਤੇ ਜਤਾ ਲਏ ਇਸੇ ਤਰ੍ਹਾਂ ਹੀ ਕਵਿਤਾਵਾਂ ਲਿਖੀਆਂ ਸੋ ਬਾਕੀ ਕਰੀਏਟਿਵ ਬਲਾਕ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਇਸ ਕਿਸਮ ਦਾ ਕੋਈ ਰਚਨਾਤਮਕ ਵਿਸ਼ਾ ਮੈਨੂੰ ਮਿਲਿਆ ਜਿਸ ਨੂੰ ਲੱਭਣ 'ਚ ਮੈਂ ਅਸਮਰਥ ਹੋਵਾਂ ਅਤੇ ਮੇਰਾ ਇਸ ਸੰਬੰਧੀ ਕੋਈ ਖਾਸ ਅਨੁਭਵ ਨਹੀਂ ਹੈ ਕਿਉਂਕਿ ਪ੍ਰਾਈਮਰੀ ਅਧਿਆਪਕ ਹਾਂ ਅਤੇ ਛੋਟੇ ਬੱਚਿਆਂ ਤੱਕ ਸੀਮਤ ਹਾਂ ਲਿਖਣਾ ਪੜ੍ਹਨਾ ਮੇਰਾ ਸ਼ੌਕ ਹੈ ਪਰ ਮੈਂ ਜੋ ਆਪਾਂ ਕਹਿ ਸਕਦੇ ਹਾਂ ਕਿ ਉੱਚ ਦਰਜੇ ਦੇ ਜਿਹੜੇ ਲੇਖਕ ਹੁੰਦੇ ਹਨ ਜਿਹਨਾਂ ਦਾ ਇੱਕ ਸਰਵੋਤਮ ਦਰਜਾ ਹੁੰਦਾ ਹੈ ਨਾ ਜਿਹਨਾਂ ਨੂੰ ਸਮਾਜ ਦੇ ਵਿੱਚ ਇੱਕ ਪਹਿਚਾਣ ਕਹਿ ਲਓ ਕਿ ਮੇਰੇ ਆਲੇ ਦੁਆਲੇ ਮੇਰੀ ਪਹਿਚਾਣ ਆ ਪਰ ਪੂਰਨ ਸਾਹਿਤ ਜਗਤ ਦੇ ਵਿੱਚ ਹਾਲੇ ਮੇਰੀ ਪਹਿਚਾਣ ਨਹੀਂ ਬਣੀ ਇੱਕ ਦੋ ਕਿਤਾਬਾਂ ਮੇਰੀਆਂ ਆਈਆਂ ਹਨ ਸੋ ਇਸ ਤਰ੍ਹਾਂ ਦਾ ਕੋਈ ਵੀ ਅਨੁਭਵ ਮੈਨੂੰ ਨਹੀਂ ਮਿਲਿਆ ਜਿਹੜਾ ਮੇਰੇ ਲਈ ਚੁਣੌਤੀਪੂਰਨ ਰਿਹਾ ਹੋਵੇ